ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਤ ਭਾਸ਼ਾ ਹੈ ਇਹ ਭਾਸ਼ਾ ਸਾਨੂੰ ਸਾਡੇ ਗੁਰੂਆਂ ਦੀ ਦੇਣ ਹੈ ਪੰਜਾਬੀ ਬੋਲੀ ਬਿੱਲਕੁਲ ਸਰਲ ਅਤੇ ਸਿੱਧੀ ਭਾਸ਼ਾ ਹੈ ਇਹ ਬੋਲੀ ਸਿੱਖਣ ਦੀ ਲੋੜ ਨਹੀਂ ਪੈਂਦੀ ਇਸ ਨੂੰ ਸੁਣ ਕੇ ਬੋਲਣਾ ਆ ਜਾਂਦਾ ਹੈ ਦੂਜੇ ਪ੍ਰਾਂਤਾਂ ਦੇ ਲੋਕ ਇੱਥੇ ਆ ਕੇ ਪੰਜਾਬੀ ਭਾਸ਼ਾ ਸਿੱਖ ਜਾਂਦੇ ਹਨ ਅਤੇ ਆਪਣੀ ਭਾਸ਼ਾ ਨੂੰ ਬੋਲਣਾ ਘੱਟ ਕਰ ਦਿੰਦੇ ਹਨ ਇਸ ਭਾਸ਼ਾ ਨੂੰ ਪੰਜਾਬ ਤੋਂ ਇਲਾਵਾ ਹੋਰ ਪ੍ਰਾਂਤਾਂ ਵਿੱਚ ਵੀ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਪਾਕਿਸਤਾਨ ਵਿੱਚ ਵੀ ਬੋਲਿਆ ਜਾਂਦਾ ਹੈ